ਵੈਸੇ ਤਾਂ ਮੈਂ ਸ਼ਹਿਰ ਦੀ ਰਹਿਣ ਵਾਲੀ ਹਾਂ ਮੈਂ ਸ਼ਹਿਰ ਦੀ ਨਿਵਾਸੀ ਹਾਂ ਸਾਡੇ ਇੱਥੇ ਚੌਵੀ ਘੰਟੇ ਬਿਜਲੀ ਰਹਿੰਦੀ ਆ ਲੇਕਿਨ ਕਦੀ ਕਦੀ ਇੱਦਾਂ ਹੁੰਦਾ ਅਸੀਂ ਸਰਕਾਰ ਦੇ ਧੰਨਵਾਦੀ ਹਾਂ ਕਿ ਸਾਨੂੰ ਬਿਜਲੀ ਦੀ ਘਾਟ ਮਹਿਸੂਸ ਨਹੀਂ ਹੁੰਦੀ ਲੇਕਿਨ ਕਦੀ ਕਦੀ ਜਿੱਦਾਂ ਗਰਮੀਆਂ ਦੇ ਮੌਸਮ 'ਚ ਬਿਜਲੀ ਦਾ ਕੱਟ ਲੱਗਦਾ ਉਦੋਂ ਸਾਡੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਜਾਂਦੀ ਆ ਜਿੱਦਾਂ ਕਿ ਜਿਹਨਾਂ ਦੇ ਛੋਟੇ ਛੋਟੇ ਬੱਚੇ ਆ ਉਹ ਗਰਮੀ ਵਿੱਚ ਨਹੀਂ ਰਹਿੰਦੇ ਹੁਣ ਜਿਹਨਾਂ ਦੇ ਤਾਂ ਇਨਵੇਟਰ ਲੱਗੇ ਹੋਏ ਆ ਉਹਨਾਂ ਨੂੰ ਕੋਈ ਤੰਗੀ ਨਹੀਂ ਆਉਂਦੀ ਲੇਕਿਨ ਜਿਹਨਾਂ ਦੇ ਨਹੀਂ ਲੱਗੇ ਹੋਏ ਉਹਨਾਂ ਲਈ ਕਾਫੀ ਮੁਸ਼ਕਲ ਹੋ ਜਾਂਦੀ ਹੈ ਪਾਣੀ ਨਹੀਂ ਆਉਂਦਾ ਪਾਣੀ ਪਾਣੀ ਤੁਹਾਨੂੰ ਪਤਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਸਾਡੇ ਪਾਣੀ ਨਹੀਂ ਆਉਂਦਾ ਅਗਰ ਬਿਜਲੀ ਦੇ ਕੱਟ ਲੱਗ ਜਾਂਦੇ ਕਾਫੀ ਲੰਬੇ ਕੱਟ ਲੱਗਦੇ ਆ ਸਰਦੀਆਂ ਵਿੱਚ ਤਾਂ ਕੱਟ ਨੇ ਬਿਜਲੀ ਦੇ ਕੱਟ ਨਹੀਂ ਲੱਗਦੇ ਲੇਕਿਨ ਜਦੋਂ ਗਰਮੀਆਂ ਵਿੱਚ ਬਿਜਲੀ ਦੇ ਕੱਟ ਲੱਗਦੇ ਆ ਫਿਰ ਸਾਨੂੰ ਮੁਸ਼ਕਲ ਹੋ ਜਾਂਦੀ ਆ ਫ੍ਰਿਜ ਵਗੈਰਾ 'ਚ ਜਿੱਦਾਂ ਅਸੀਂ ਵਰਤੋਂ ਕਰਦੇ ਹਾਂ ਫਰਿਜਾਂ ਦੀ ਉਹ ਵੀ ਸਾਡੇ ਬੰਦ ਹੋ ਜਾਂਦੇ ਆ ਪੱਖੇ ਬੰਦ ਹੋ ਜਾਂਦੇ ਆ ਏ ਸੀ ਵਗੈਰਾ ਨਹੀਂ ਚੱਲਦੇ ਬਸ ਇਹ ਸਾਨੂੰ ਇਹਦੇ ਵਿੱਚ ਜ਼ਿਆਦਾ ਤੰਗੀ ਆਉਂਦੀ ਹੈ ਕੂਲਰ ਵਗੈਰਾ ਨਹੀਂ ਚੱਲਦੇ ਜਿਹਨਾਂ ਕੋਲ ਹੈ ਮਤਲਬ ਕਿ ਬਿਜਲੀ ਦੇ ਜਿਹੜੇ ਉਪਕਰਨ ਆ ਉਹ ਉਹਨਾਂ ਦੀ ਵਰਤੋਂ ਨਹੀਂ ਅਸੀਂ ਕਰ ਸਕਦੇ ਹਾਂ ਬਿਜਲੀ ਤੋਂ ਵੀ ਬਿਨਾ ਹੀ ਅਤੇ ਇਸ ਬਸ ਐਸੀ ਇਹੀ ਕਹਿ ਸਕਦੇ ਹਾਂ ਕਿ ਜਦੋਂ ਕੱਟ ਲੱਗਦੇ ਆ ਤਾਂ ਉਸ ਟਾਈਮ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਆ ਪਰ ਫਿਰ ਵੀ ਅਸੀਂ ਇੱਕ ਵਾਰੀ ਫੇਰ ਦੁਬਾਰਾ ਅਸੀਂ ਸਰਕਾਰ ਨੂੰ ਧੰਨਵਾਦ ਦਿੰਦੇ ਹਾਂ ਕਿ ਸਾਨੂੰ ਇੱਦਾਂ ਦੀ ਨੌਬਤ ਤੋਂ ਨਿਜਾਤ ਮਿਲੀ ਹੋਈ ਇੱਦਾਂ ਦੀ ਨੌਬਤ ਨਹੀਂ ਆਈ ਕਦੀ ਇੰਨੇ ਬਿਜਲੀ ਦੇ ਕੱਟ ਲੱਗੇ ਹੋਣ